ਹੈਲੋ ਹੈਲੋ ਹੈਲੋ ਹਾਂਜੀ ਨਮਸਤੇ ਸਰ ਹਾਂਜੀ ਮੈਂ ਹੁਸ਼ਿਆਰਪੁਰ 'ਚ ਨਵੀਂ ਨਵੀਂ ਆਈ ਆ ਅਤੇ ਮੈਨੂੰ ਤੁਸੀਂ ਦੱਸਿਓ ਮੈਡੀਕਲ ਸਟੋਰ ਕੋਈ ਵਧੀਆ ਜਿਹਾ ਦਵਾਈ ਲੈਣੀ ਸੀ ਹਾਂਜੀ ਓਕੇ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਸਰ ਅੱਛਾ ਜੀ ਓਕੇ ਸਰ ਜੇ ਅਗਰ ਗੁਲੂਕੋਜ਼ ਵਗੈਰਾ ਲਗਾਉਣਾ ਹੋਵੇ ਤਾਂ ਕੋਈ ਇਜ਼ੈਕਸ਼ਨ ਵਗੈਰਾ ਲਗਾਉਣਾ ਹੋਵੇ ਤਾਂ ਅੱਛਾ ਹਾਂਜੀ ਹਾਂਜੀ ਸਰਕਾਰੀ ਕਾਰਡ ਕਿੰਨੇ ਦਾ ਬਣਦਾ ਅੱਛਾ ਜੀ ਅਤੇ ਉਹ ਸਾਨੂੰ ਕਾਰਡ ਦਿਖਾ ਕੇ ਫਰੀ ਟ੍ਰੀਟਮੈਂਟ ਕਰਾ ਸਕਦੇ ਹਾਂ ਅੱਛਾ ਜੀ ਅੱਛਾ ਜੀ ਜਿਹੜਾ ਆਯੁਸ਼ਮਾਨ ਕਾਰਡ ਆ ਇਹ ਹੋਰ ਹੋਸਪਿਟਲ 'ਚ ਨਹੀਂ ਚੱਲ ਸਕਦਾ ਅੱਛਾ ਜੀ ਠੀਕ ਆ ਸਰ ਅੱਛਾ ਜੀ ਜਿਹੜੇ ਸਰਕਾਰੀ ਹੋਸਪਿਟਲ ਆ ਉੱਥੇ ਸਾਨੂੰ ਹਰ ਸਹੂਲਤ ਮਿਲ ਸਕਦੀ

ਜਿਹੜੇ ਸਰਕਾਰੀ ਹੋਸਪਿਟਲ ਆ ਅਤੇ ਉੱਥੇ ਸਾਨੂੰ ਜਿਹੜਾ ਸਾਨੂੰ ਟ੍ਰੀਟਮੈਂਟ ਅਸੀਂ ਕਰਵਾਉਣਾ ਵਾ ਉੱਥੇ ਹੋ ਸਕਦਾ ਪੂਰਾ ਠੀਕ ਆ ਉਥੋਂ ਮਿਲੇਗੀ ਕਿ ਸਾਨੂੰ ਬਾਹਰੋਂ ਲੈਣੀ ਪਏਗੀ ਅੱਛਾ

ਅੱਛਾ ਜੀ ਠੀਕ ਆ ਅੱਛਾ ਜੀ ਠੀਕ ਆ ਜੇ ਸਾਨੂੰ ਤੁਸੀਂ ਦੱਸ ਦਓਗੇ ਕਿ ਬਾਹਰ ਓਕੇ ਜੀ